ਕੋਈ ਜੇ ਬੱਚਾ ਘਰ 'ਚ ਪੈਦਾ ਹੋਇਆ ਤਾਂ ਫਿਕਰ ਵਾਲੀ ਗੱਲ ਨਹੀਂ ਜਨਮ ਸਰਟੀਫਿਕੇਟ ਬਣ ਸਕਦਾ ਪਰ ਹਸਪਤਾਲ ਵਾਲੇ ਕੇਸ ਨਾਲੋਂ ਥੋੜ੍ਹੀ ਹੋਰ ਦੌੜ ਭੱਜ ਕਰਨੀ ਪੈ ਸਕਦੀ ਹੈ ਸਭ ਤੋਂ ਪਹਿਲਾਂ ਦਸਤਾਵੇਜ਼ ਲੈ ਆਈਏ ਮੈਂ ਤੈਨੂੰ ਦੱਸਦਾ ਹਾਂ ਮਾਤਾ ਪਿਤਾ ਨੂੰ ਇੱਕ ਸ਼ਬਦ ਪੱਤਰ ਬਣਾਉਣਾ ਪੈਂਦ ਪਵੇਗਾ ਜਿਸ ਵਿੱਚ ਜਿਸ 'ਚ ਲਿਖਿਆ ਹੋਵੇ ਕਿ ਬੱਚਾ ਕਿੱਥੇ ਅਤੇ ਕਦੋਂ ਪੈਦਾ ਹੋਇਆ ਫਿਰ ਗ੍ਰਾਮ ਪੰਚਾਇਤ ਜਾਂ ਮੁਹੱਲੇ ਦੇ ਨੰਬਰਦਾਰ ਤੋਂ ਪੁਸ਼ਟੀ ਪੱਤਰ ਵੀ ਲੈ ਆਈਏ ਇਹ ਅਸੀਂ ਪੰਚਾਇਤ ਆਫਿਸ ਜਾਂ ਐਸ ਡੀ ਐਮ ਦਫ਼ਤਰ 'ਚ ਦੇਵਾਂਗੇ ਹੁਣ ਅਸੀਂ ਰਜਿਸਟਰੇਸ਼ਨ ਕਰਵਾਉਣੀ ਆ ਚੱਲ ਮਿਊਂਸੀਪਲ ਆਫਿਸ ਜਾਂ ਪੰਚਾਇਤ ਦਫ਼ਤਰ ਜਾਈਏ ਉੱਥੇ ਜਨਮ ਰਜਿਸਟਰੇਸ਼ਨ ਦੀ ਅਰਜੀ ਦੇਣੀ ਪੈਣੀ ਅਸੀਂ ਆਪਣਾ ਆਧਾਰ ਕਾਰਡ ਪਤਾ ਪ੍ਰਮਾਣ ਅਤੇ ਮਾਤਾ ਪਿਤਾ ਦੇ ਦਸਤਾਵੇਜ਼ ਵੀ ਲੈ ਜਾਈਏ ਜੇਕਰ ਆਨਲਾਈਨ ਕਰਨਾ ਹੋਵੇ ਕਈ ਸਟੇਟਾਂ ਵਿੱਚ ਤਾਂ ਵੀ ਅਰਜੀ ਦੇ ਸਕਦੇ ਹਾਂ ਉੱਥੇ ਸਾਰੇ ਦਸਤਾਵੇਜ ਅਪਲੋਡ ਕਰਕੇ ਫਾਰਮ ਭਰਨਾ ਪੈਣਾ ਫਿਰ ਜਨਮ ਸਰਟੀਫਿਕੇਟ ਮਿਲ ਜੂ ਆਰਡਨਲੀ ਕੇਸ 'ਚ ਦਸ ਪੰਦਰਾਂ ਦਿਨ ਲੱਗ ਜਾਂਦੇ ਪਰ ਜੇਕਰ ਇੱਕੀ ਦਿਨਾਂ ਤੋਂ ਜ਼ਿਆਦਾ ਹੋ ਗਿਆ ਤਾਂ ਕਈ ਦਿਨ ਵਾਰ ਕਈ ਕਈ ਵਾਰ ਐਸ ਡੀ ਐਮ ਤੋਂ ਵਧੇਰੀ ਮਨਜ਼ੂਰੀ ਲੈਣੀ ਪੈ ਸਕਦੀ ਹੈ ਚੱਲ ਹੁਣ ਕਿੰਨੇ ਲੰਬੇ ਚੱਕਰ 'ਚ ਨਾ ਪੈ ਜਾਣ ਅੱਜ ਕੱਲ੍ਹ ਚੱਲ ਕੇ ਕਰ ਲਈਏ ਧੰਨਵਾਦ